ਅਗਰ ਕਵਿਤਾ ਦੀ ਗੱਲ ਕੀਤੀ ਜਾਵੇ ਤਾਂ ਕਵਿਤਾ ਬੰਦੇ ਦੇ ਮਨ ਵਿੱਚ ਆਏ ਵੱਖ ਵੱਖ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੈ ਇਸ ਸੰਬੰਧ ਵਿੱਚ ਮੇਰੀ ਆਪਣੀ ਲਿਖਣੀ ਤਾਂ ਵਿੱਚ ਤਾਂ ਕੋਈ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਜਾ ਸਕਦਾ ਪਰੰਤੂ ਇਸ ਸੰਬੰਧੀ ਅਗਰ ਮੈਂ ਗੱਲ ਕਰਾਂ ਤਾਂ ਮੈਨੂੰ ਇੱਕ ਪੰਜਾਬੀ ਗੀਤ ਬਹੁਤ ਹੀ ਜੋ ਬਹੁਤ ਹੀ ਪਸੰਦ ਹੈ ਜੋ ਕਿ ਮਾਂ ਦੇ ਉੱਪਰ ਲਿਖਿਆ ਗਿਆ ਹੈ ਜਿਸਦੇ ਕਿ ਬੋਲ ਹਨ ਕਿ ਮਾਂ ਵਰਗਾ ਵਡਮੁੱਲਾ ਬੂਟਾ ਜੋ ਜੋ ਹਰਭਜਨ ਮਾਨ ਵੱਲੋਂ ਗਾਇਆ ਗਿਆ ਹੈ ਮੈਨੂੰ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਤਾਂ ਇਸ ਵਿੱਚ ਮਾਂ ਦੀ ਮਹੱਤਤਾ ਬਾਰੇ ਬੜਾ ਚੰਗਾ ਵਰਣਨ ਕੀਤਾ ਗਿਆ ਹੈ ਅਤੇ ਇਸ ਵਿੱਚ ਉਹਨਾਂ ਨੇ ਮਾਂ ਦਾ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਇਹ ਕਿਹਾ ਹੈ ਕਿ ਰੱਬ ਤੋਂ ਬਾਅਦ ਅਗਰ ਆਪਾਂ ਜੇ ਕਿਸੇ ਦੀ ਦਾ ਜ਼ਿਕਰ ਕਰੀਏ ਤਾਂ ਉਹ ਮਾਂ ਹੈ ਅਤੇ ਮਾਂ ਬੰਦੇ ਦੀ ਮਨੁੱਖ ਦੀ ਪਹਿਲੀ ਅਧਿਆਪਕਾ ਜਾਂ ਕਹਿ ਲਉ ਟੀਚਰ ਵੀ ਹੁੰਦੀ ਹੈ ਪਹਿਲੀ ਗੁਰੂ ਹੁੰਦੀ ਹੈ ਅਤੇ ਮੈਂ ਇਹ ਗੀਤ ਆਪਣੀ ਮਾਂ ਨੂੰ ਸੁਣਾਇਆ ਅਤੇ ਮੇਰੇ ਮਾਤਾ ਜੀ ਨੂੰ ਇਹ ਬਹੁਤ ਹੀ ਪਸੰਦ ਆਇਆ ਅਤੇ ਉਹਨਾਂ ਨੇ ਬਹੁਤ ਤਾਰੀਫ ਕੀਤੀ ਅਤੇ ਆਪਣੇ ਆਸ਼ੀਰਵਾਦ ਅਤੇ ਅਸੀਸਾਂ ਦਿੱਤੀਆਂ